ਮੈਂ ਆਪਣਾ ਘਰ ਬਣਾਉਣ ਤੋਂ ਪਹਿਲਾਂ ਆਪਣੇ ਪਲਾਟ ਦੀ ਜਗ੍ਹਾ ਦਾ ਮੁਲਾਂਕਣ ਕਰਾਂਗਾ ਕਿ ਮੇਰੇ ਕੋਲ ਕਿੰਨੀ ਕੁ ਜਗ੍ਹਾ ਹੈ ਅਤੇ ਉਸ ਹਿਸਾਬ ਨਾਲ ਹੀ ਮੈਂ ਆਪਣੇ ਘਰ ਦੀ ਨੀਂਹ ਰੱਖਾਂਗਾ ਆਪਣੇ ਘਰ ਦੀ ਨੀਂਹ ਰੱਖਣ ਤੋਂ ਪਹਿਲੇ ਮੈਂ ਆਪਣੇ ਆਲਾ ਦੁਆਲਾ ਦੇਖਾਂਗਾ ਕਿ ਮੇਰੇ ਘਰ ਦੇ ਕੋਲ ਕੋਈ ਜੰਗਲੀ ਜਾਨਵਰ ਤਾਂ ਨਹੀਂ ਰਹਿੰਦਾ ਮੈਂ ਆਪਣੇ ਘਰ ਦੀ ਨੀਂਹ ਰੱਖਣ ਤੋਂ ਬਾਅਦ ਆਪਣੇ ਆਪਣੇ ਪਰਿਵਾਰ ਦੀ ਜ਼ਰੂਰਤਾਂ ਨੂੰ ਵੀ ਧਿਆਨ 'ਚ ਰੱਖਾਂਗਾ ਕਿ ਮੇਰੇ ਘਰ ਦੇ ਮੈਂਬਰਾਂ ਨੂੰ ਕਿੰਨੇ ਕਮਰੇ ਚਾਹੀਦੇ ਹਨ ਅਤੇ ਕਿੰਨੀ ਕੁ ਸਾਈਜ਼ ਵਿੱਚ ਚਾਹੀਦੇ ਹਨ ਅਤੇ ਕਿਚਨ ਕਿੱਥੇ ਚਾਹੀਦੀ ਹੈ ਪਿੰਡ ਵਿ ਪਿੰਡ ਵਿੱਚ ਘਰ ਬੜੇ ਹੀ ਖੁੱਲੇ ਹੁੰਦੇ ਹਨ ਅਤੇ ਉਥੋਂ ਦਾ ਉਥੋਂ ਦੇ ਪਲਾਟ ਦੀ ਜਗ੍ਹਾ ਵੀ ਬਹੁਤ ਜ਼ਿਆਦਾ ਹੁੰਦੀ ਹੈ ਉਥੋਂ ਦਾ ਇਕ ਉਹ ਪਿੰਡਾਂ ਦੇ ਘਰਾਂ ਵਿਚ ਖਾਸ ਕਰਕੇ ਇੱਕ ਵਿਹੜਾ ਜ਼ਰੂਰ ਹੁੰਦਾ ਹੈ ਤਾਂ ਕਿ ਉਥੋਂ ਦੇ ਉਸ ਘਰ ਦੇ ਬਜ਼ੁਰਗ ਖੁੱਲੀ ਹਵਾ ਵਿੱਚ ਰਹਿ ਸਕਣ ਅੱਜ ਕੱਲ੍ਹ ਦੇ ਸਾਲਾਂ ਵਿੱਚ ਪਿੰਡਾਂ ਵਿੱਚ ਵੀ ਹੀ ਸ਼ਹਿਰ ਵਾਂਗ ਕੋਠੀਆਂ ਬਣਾਈ ਜਾ ਰਹੀਆਂ ਹਨ